ਬਚਪਨ ਤੋਂ ਹੀ ਮੈਨੂੰ ਕੁਦਰਤ ਦੇ ਅਸੀਮ ਨਜ਼ਾਰੇ ਜੋ ਹੈ ਉਹ ਬਹੁਤ ਜ਼ਿਆਦਾ ਕੁਦਰਤ ਦੇ ਅੰਜਾ ਅੰਦਾਜ਼ ਬਹੁਤ ਜ਼ਿਆਦਾ ਸੁੰਦਰ ਲੱਗਦੇ ਸੀ ਇਸ ਕਰਕੇ ਮੈਂ ਉਨ੍ਹਾਂ ਨੂੰ ਕੁਦਰਤ ਦੇ ਉਨ੍ਹਾਂ ਨਜ਼ਾਰਿਆਂ ਨੂੰ ਫੋਟੋਆਂ ਦੇ ਵਿੱਚ ਕੈਦ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਹੌਲੀ ਹੌਲੀ ਫਿਰ ਉਸ ਤੋਂ ਬਾਅਦ ਮੈਂ ਇੱਕ ਕੈਮਰਾ ਖਰੀਦਿਆ ਅਤੇ ਉਸ ਦੇ ਵਿੱਚ ਮੈਂ ਬ ਕੁਦਰਤ ਦੇ ਸਾਰੇ ਨਜ਼ਾਰਿਆਂ ਨੂੰ ਕੈਦ ਕਰਨਾ ਸ਼ੁਰੂ ਕੀਤਾ ਅਤੇ ਇਸ ਤਰ੍ਹਾਂ ਹੌਲੀ ਹੌਲੀ ਮੈਨੂੰ ਫੋਟੋਗ੍ਰਾਫੀ ਕਰਨ ਦਾ ਸ਼ੌਂਕ ਪੈ ਗਿਆ ਇਸ ਤਰੀਕੇ ਦੇ ਨਾਲ ਮੈਂ ਹੁ ਹੁਣ ਤੱਕ ਵੀ ਮੈਂ ਜਿੰਨੇ ਵੀ ਕੁਦਰਤ ਦੇ ਅਜ ਅੰਦਾਜ਼ ਹਨ ਕੁਦਰਤ ਦੇ ਨਜ਼ਾਰੇ ਹਨ ਅਲੱਗ ਅਲੱਗ ਥਾਵਾਂ ਤੋਂ ਬਹੁਤ ਸਾਰੀਆਂ ਬਹੁਤ ਸਾਰੇ ਸਾਰੇ ਅਜਿਹੇ ਨਜ਼ਾਰਿਆਂ ਨੂੰ ਕੈਦ ਕਰਨਾ ਸ਼ੁਰੂ ਕੀਤਾ